ਮੁਨਸ਼ੀ ਪ੍ਰੇਮ ਚੰਦ ਬਹੁਤ ਵਧੀਆ ਲੇਖਕ ਹੈ ਮੇਰੇ ਮਨ ਪਸੰਦ ਦੇ ਲੇਖਕ ਨੇ ਪ੍ਰੇਮ ਚੰਦ ਬਹੁਤ ਵਧੀਆ ਪ੍ਰਤੀਭਾ ਦੇ ਮਾਲਕ ਸੀ ਉਹਨਾਂ ਨੇ ਆਪਣੀਆਂ ਸ ਕਹਾਣੀ ਨਾਟਕ ਹਰੇਕ ਵਿਸ਼ੇ ਦੇ ਸਾਹਿਤ ਦੀ ਰਚਨਾ ਕੀਤੀ ਸੀ ਪ੍ਰੇਮ ਚੰਦ ਨੇ ਪ੍ਰੇਮ ਚੰਦ ਤਿੰਨ ਨਾਟਕ ਬੜੇ ਮਸ਼ਹੂਰ ਹੋਏ ਸਨ ਜਿਹਨਾਂ ਵਿੱਚੋਂ ਸੰਗ੍ਰਾਮ ਕਰਭਲਾ ਪ੍ਰੇਮ ਕੀ ਬੇਟੀ ਪ੍ਰੇਮ ਚੰਦ ਜੀ ਨੇ ਤਿੰਨ ਸੌ ਤੋਂ ਵੱਧ ਕਹਾਣੀਆਂ ਲਿਖੀਆਂ ਡੇਢ ਦਰਜਨ ਨਾਵਲ ਲਿਖੇ ਮੈਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਵਧੀਆ ਜਿਉਣ ਦੀ ਸਿੱਖਿਆ ਮਿਲਦੀ ਹੈ ਉਹ ਬਹੁਤ ਵਧੀਆ ਲੇਖਕਕਾਰ ਸਨ ਉਹ ਬਹੁਤ ਵਧੀਆ ਨਾਵਲਕਾਰ ਸਨ ਉਹ ਬਹੁਤ ਵਧੀਆ ਕਹਾਣੀਕਾਰ ਸਨ